ਮੈਨੂੰ ਸਵੇਰ ਦੀ ਸੈਰ ਬਹੁਤ ਹੀ ਅੱਛੀ ਆ ਲੱਗਦੀ ਆ ਅਤੇ ਮੈਂ ਹਮੇਸ਼ਾ ਆਪਣੇ ਬਗੀਚੇ ਦੇ ਵਿੱਚ ਜਾ ਕੇ ਇਹ ਸੈਰ ਕਰਦਾ ਹੁੰਦਾ ਹਾਂ ਜਿੱਥੇ ਮੈਂ ਆਪਣੇ ਕੁਛ ਪੌਦੇ ਲਗਾ ਰੱਖੇ ਹਨ ਛੋਟੇ ਮੋ ਫੁੱਲਾਂ ਵਾਲੇ ਫੁਲਵਾਰੀ ਬਣਾਈ ਹੋਈ ਹੈ ਗਾਰਡਨਿੰਗ ਕੀਤੀ ਹੋਈ ਹੈ ਉਹਨੂੰ ਬਾਗਬਾਨੀ ਕੀਤੀ ਹੋਈ ਆ ਅਤੇ ਉਸ ਨੂੰ ਮੈਂ ਸਵੇਰੇ ਉੱਠ ਕੇ ਜਦੋਂ ਜਾਂਦਾ ਹਾਂ ਸੈਰ ਵਾਸਤੇ ਤਾਂ ਉਦੋਂ ਮੈਂ ਉੱਥੇ ਜਾ ਕੇ ਬਾਗ ਦੇ ਵਿੱਚ ਬੂਟਿਆਂ ਦੀ ਗੋਡੀ ਵੀ ਕਰਦਾ ਹਾਂ ਉਹਨਾਂ ਨੂੰ ਪਾਣੀ ਵੀ ਦੇਈਦਾ ਹੈ ਅਤੇ ਜੋ ਪੱਤੇ ਖ਼ਰਾਬ ਹੁੰਦੇ ਹਨ ਜਾਂ ਟੁੱਟੇ ਹੋਏ ਹੁੰਦੇ ਹਨ ਉਹ ਸਾਫ਼ ਕਰਕੇ ਉਹਨਾਂ ਦਾ ਉਹਨਾਂ ਨੂੰ ਬਾਹਰ ਸੁੱਟ ਦਿੰਦਾ ਹਾਂ ਇਸ ਤਰ੍ਹਾਂ ਮੈਂ ਆਪਣੀ ਬਾਕੀ ਡੇਲੀ ਦੀ ਰੂਟੀਨ ਵੀ ਪੂਰੀ ਕਰਕੇ ਆ ਕੇ ਆਪਣਾ ਕੰਮ 'ਤੇ ਚਲੇ ਜਾਈਦਾ ਹੈ ਅਤੇ ਉਸ ਤੋਂ ਬਾਅਦ ਜਦੋਂ ਮੈਂ ਵਾਪਸ ਆਉਂਦਾ ਹਾਂ ਸ਼ਾਮ ਨੂੰ ਅਤੇ ਉਹਦੇ ਬਾਅਦ ਫਿਰ ਮੈਨੂੰ ਸ਼ਾਮ ਦੀ ਜਿਹੜੀ ਹੈਗੀ ਹੈ ਉਹ ਅੱਛੀ ਲੱਗਦੀ ਹੈ ਸੈਰ ਆਪਣੇ ਬਾਗ ਦੇ ਵਿੱਚ ਜਾਣ ਦੀ ਅਤੇ ਉਦੋਂ ਆ ਕੇ ਫਿਰ ਮੈਂ ਉੱਥੇ ਆਪਣੇ ਬਾਗ ਦੇ ਵਿੱਚ ਜਾਂਦਾ ਹਾਂ ਅਤੇ ਸ਼ਾਮ ਨੂੰ ਆ ਕੇ ਫਿਰ ਇੱਕ ਵਾਰੀ ਆਪਣੇ ਲਗਾਏ ਹੋਏ ਉਹਨਾਂ ਪੌਦਿਆਂ ਨੂੰ ਦੇਖਦਾ ਹਾਂ ਅਤੇ ਬਈ ਉਹਨਾਂ ਉੱਤੇ ਸਪਰੇ ਵਗੈਰਾ ਕਰਨ ਵਾਲੀ ਹੈ ਜਾਂ ਕੋਈ ਕੀਟਨਾਸ਼ਕ ਦਵਾ ਛਿੜਕਣ ਵਾਲੀ ਹੈ ਤਾਂ ਉਹ ਮੈਂ ਉਹਨਾਂ ਨੂੰ ਛਿੜਕਦਾ ਹਾਂ ਅਤੇ ਇਸ ਹਿਸਾਬ ਨਾਲ ਮੈਂ ਆਪਣੇ ਜੋ ਟਾਈਮ ਹੈ ਮੇਰਾ ਜਿਹੜੇ ਉਹ ਵੀ ਆਪਣੀ ਸਥਿਰ ਰੱਖਦਾ ਹਾਂ ਅਭਿਆਸ ਵੀ ਅਤੇ ਉਹ ਵੀ ਉਸਦੇ ਬਾਅਦ ਵੀ ਬਾਕੀ ਜਿਹੜਾ ਕੰਮ ਹੈ ਬਾਗ ਦਾ ਵਾ ਉਹ ਵੀ ਮੈਂ ਉਸ ਰੂਟੀਨ ਨਾਲ ਕਰ ਲੈਂਦਾ ਹਾਂ ਇਸ ਤਰੀਕੇ ਨਾਲ ਮੈਂ ਆਪਣੇ ਦੋਨੋਂ ਹ ਕੰਮਾਂ ਨੂੰ ਆਪਣਾ ਬਹੁਤ ਅੱਛੇ ਅਤੇ ਸੰਯਮ ਢੰਗ ਦੇ ਨਾਲ ਜੋੜ ਕੇ ਰੱਖਦਾ ਹਾਂ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਾ ਹੋਵੇ ਮੇਰੇ ਬਾਗ ਵੀ ਸਹੀ ਰਹਿਣ ਔਰ ਮੇਰਾ ਡੇਲੀ ਰੋ ਜਿਹੜਾ ਅਭਿਆਸ ਆ ਮੇਰਾ ਜੋ ਉਹ ਆਪਣਾ ਕੰਮ ਕਾਜ ਆ ਉਹ ਵੀ ਨਿਬੜਦਾ ਰਹੇ